ਪੰਜਾਬ ਵਿੱਚ ਕੁਝ ਮੁੱਖ ਸਿਹਤ ਚਿੰਤ ਚਿੰਤਾਵਾਂ ਹੇਠ ਲਿਖੀਆਂ ਹਨ ਨਸ਼ੇ ਦੀ ਲੱਤ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਗੰਭੀਰ ਰੂਪ ਧਾਰ ਕਰ ਚੁੱਕੀ ਹੈ ਨਸ਼ੇ ਦੀ ਆਦਤ ਲੱਤ ਖ਼ਾਸ ਕਰ ਯੂਵਾ ਵਰਗ ਵਿੱਚ ਵੀ ਇੱਕ ਵੱਡੀ ਚਿੰਤਾ ਹੈ ਜੋ ਸਿਹਤ ਸਮਾਜਿਕ ਜੀਵਨ ਅਤੇ ਆਰਥਿਕ ਅਤੇ ਨਾਕਰਾਤਮਕ ਪ੍ਰਭਾਵ ਪਾ ਰਹੀ ਹੈ ਡਾਈਬਿਟੀਜ ਅਤੇ ਦਿਲ ਦੀਆਂ ਬਿਮਾਰੀਆਂ ਭੋਜਨ ਵਿੱਚ ਵਧੇਰੇ ਚਰਬੀ ਅਤੇ ਸ਼ੱਕਰ ਦੇ ਸੇਵਨ ਕਰਕੇ ਡਾਈਬਿਟੀਜ ਅਤੇ ਦਿਲ ਦੀਆਂ ਬਿਮਾਰੀਆਂ ਦੀ ਦਰ ਵੱਧ ਰਹੀ ਹੈ ਕੈਂਸਰ ਪੰਜਾਬ ਦੇ ਕੁਝ ਖੇਤਰਾਂ ਵਿੱਚ ਕੈਂਸਰ ਦੇ ਮਾਮਲੇ ਬਹੁਤ ਵੱਧ ਗਏ ਹਨ ਇਸ ਲਈ ਇੱਕ ਵੱਡੀ ਵਜ੍ਹਾ ਖੇਤੀ ਵਿੱਚ ਵਰਤੇ ਜਾਣ ਵਾਲੇ ਕੀਟਨਾਸ਼ਕ ਅਤੇ ਰਸਾਇਣ ਹਨ ਪਾਣੀ ਦੀ ਗੁਣਵੱਤਾ ਪਾਣੀ ਦੀ ਪਰ ਪ੍ਰਦਰਸ਼ਿਤ ਅਤੇ ਚੈਰੀ ਦੇ ਪਦਾਰਥਾਂ ਦੀ ਮੌਜ਼ੂਦਗੀ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਜਨਮ ਲੈ ਰਹੀਆਂ ਹਨ ਵਾਧੂ ਭਾਰ ਅਤੇ ਮੋਟਾਪਾ ਸ਼ਮੂਲੀਅਤ ਖਾਣ ਪੀਣ ਅਤੇ ਸਰੀਰਕ ਕਸਰਤ ਦੀ ਘਾਟ ਕਾਰਨ ਵਾਧੂ ਭਾਰ ਅਤੇ ਮੋਟਾਪਾ ਵੱਧ ਰਹੇ ਹਨ